ਪੰਜ ਜਨਵਰੀ ਦੋ ਹਜ਼ਾਰ ਇੱਕ ਅਠਾਰ੍ਹਾਂ ਫਰਵਰੀ ਦੋ ਹਜ਼ਾਰ ਦਸ ਨੌਂ ਮਈ ਦੋ ਹਜ਼ਾਰ ਉੱਨੀ ਪੰਦਰ੍ਹਾਂ ਅਪ੍ਰੈਲ ਦੋ ਹਜ਼ਾਰ ਵੀਹ ਸੌਲ੍ਹਾਂ ਜੂਨ ਦੋ ਹਜ਼ਾਰ ਚੌਵੀ